ਹਾਂਜੀ ਹਾਂਜੀ ਹਾਂਜੀ ਬੰਸਲ ਸੂਜ਼ ਹਾਊਸ ਤੋਂ ਬੋਲ ਰਹੇ ਹਾਂ ਜੀ

ਹਾਂਜੀ ਹਾਂਜੀ ਤੁਹਾਡੇ ਕੋਲ ਸਾਰੇ ਤਰ੍ਹਾਂ ਦੇ ਬੂਟ ਹੁੰਦੇ ਆ ਜੀ ਸਪੋਰਟ ਸ਼ੂਜ਼ ਫੋਰਮਲ ਸ਼ੂਜ਼ ਕਿਸ ਤਰ੍ਹਾਂ ਦੇ ਤੁਸੀਂ ਲੈਣੇ ਆ ਹਰੇਕ ਕੰਪਨੀ ਦੇ ਮਿਲ ਜਾਣਗੇ ਰਿਬੋਕ ਦੇ ਐਡੀਡਾਸ ਦੇ ਪਿਊਮਾ ਦੇ ਕਿਸ ਤਰ੍ਹਾਂ ਦੇ ਤੁਸੀਂ ਲੈਣਾ ਪਸੰਦ ਕਰੋਗੇ ਉਸ ਤਰ੍ਹਾਂ ਦੇ ਸਨੀਕਰ ਵਗੈਰਾ ਵੀ ਸਾਡੇ ਕੋਲ ਮਿਲ ਜਾਣਗੇ ਜੀ ਹਾਂ ਸਾਡੀ ਸ਼ੋਪ 'ਤੇ ਫਿਫਟੀ ਪਰਸੈਂਟ ਡਿਸਕਾਉਂਟ ਚੱਲ ਰਿਹਾ ਜੀ ਹਾਂਜੀ ਰਨਿੰਗ ਸ਼ੂਜ਼ ਵੀ ਮਿਲ ਜਾਣਗੇ ਵਾਕਿੰਗ ਸ਼ੂਜ਼ ਵੀ ਮਿਲ ਜਾਣਗੇ ਸਾਡੇ ਕੋਲ ਉਹਦੇ ਰੈਡ ਟੇਪ ਦੇ ਸ਼ੂਜ਼ ਹੈਗੇ ਆ ਜੀ ਰਨਿੰਗ ਅਤੇ ਵੋਕਿੰਗਸ ਦੇ ਵਿੱਚ ਸਕੈਚਰ ਦੇ ਸ਼ੂਜ਼ ਹੈਗੇ ਹੈ ਜੀ ਰਨਿੰਗ ਅਤੇ ਵੋਕਿੰਗ ਦੇ ਵਿੱਚ ਬੱਚਿਆਂ ਵਾਲੇ ਦੇ ਲਈ ਵੀ ਲਾਈਟਾਂ ਦੇ ਬਹੁਤ ਵਧੀਆ ਕੁਆਲਿਟੀ ਆਈ ਵੀ ਆ ਸਾਡੇ ਕੋਲ ਤੁਸੀਂ ਜਿਸ ਤਰ੍ਹਾਂ ਦੇ ਵੀ ਛੋਟੇ ਬੱਚੇ ਦੇ ਵੱਡੇ ਬੱਚੇ ਦੇ ਸਾਰੇ ਤਰ੍ਹਾਂ ਦੇ ਬੂਟ ਸਾਡੇ ਕੋਲੋਂ ਮਿਲ ਜਾਣਗੇ ਬਹੁਤ ਸੋਹਣੀ ਸੋਹਣੀ ਕੁਆਲਿਟੀ ਦੇ ਬਹੁਤ ਸੋਹਣੀਆਂ ਸੋਹਣੀਆਂ ਲਾਈਟਾਂ ਦੇ ਵਿੱਚ ਸਾਡੇ ਕੋਲੋਂ ਤੁਹਾਨੂੰ ਬੂਟ ਮਿਲ ਜਾਣਗੇ ਜੀ ਹਾਂ ਸਾਡੇ ਕੋਲ ਇ ਇੱਕ ਨੰਬਰ ਤੋਂ ਲੈ ਕੇ ਦਸ ਨੰਬਰ ਤੱਕ ਦੇ ਸਾਰੇ ਤਰ੍ਹਾਂ ਦੇ ਬੂਟ ਹੋਣਗੇ ਜੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਜੋ ਵੀ ਆਪਣੇ ਹੈਗੇ ਆ ਉਹਨਾਂ ਦੇ ਵੀ ਸਾਡੇ ਕੋਲ ਬੂਟ ਮਿਲ ਜਾਣਗੇ ਜੀ ਹਾਂਜੀ ਔਨਲਾਈਨ ਡਿਲੀਵਰੀ ਕਰ ਦਾਂਗੇ ਔਨਲਾਈਨ ਡਿਲੀਵਰੀ ਦੇ ਲਈ ਸਾਨੂੰ ਤੁਸੀਂ ਆਪਣਾ ਅਡਰੈੱਸ ਭੇਜ ਦਿਓ ਅਸੀਂ ਉਹਦੀ ਕੋਈ ਫਰੀ ਸ਼ਿਪਿੰਗ ਅ ਫਰੀ ਕਰਾਂਗੇ ਤੁਹਾਨੂੰ ਕੋਈ ਵੀ ਉਹਦੇ ਚਾਰਜਸ ਨਹੀਂ ਲੈਂਦੇ ਜੀ ਹਾਂਜੀ ਜ਼ਰੂਰ ਆ ਜਾਇਓ ਤੁਸੀਂ ਇੱਕ ਵਾਰ ਵਿਜਿਟ ਕਰੋ ਤੁਹਾਨੂੰ ਅਸੀਂ ਹੋਰ ਵੀ ਵਧੀਆ ਕੁਆਲਿਟੀ ਦੇ ਅਤੇ ਵਧੀਆ ਸੋਹਣੇ ਸੋਹਣੇ ਸ਼ੂਜ਼ ਤੁਹਾਨੂੰ ਠੀਕ ਹੈ ਜੀ